ਹਾਂਜੀ ਅਸੀਂ ਕਈ ਬਹੁਤ ਵਾਰ ਆਪਣੇ ਯਾਰਾਂ ਦੋਸਤਾਂ ਨਾਲ ਸਾਈਕਲ ਦੇ ਉੱਪਰ ਘੁੰਮਣ ਗਏ ਹਾਂ ਅਤੇ ਸਾਈਕਲ ਦੇ ਉੱਪਰ ਘੁੰਮਣ ਦਾ ਆਪਣਾ ਹੀ ਆਨੰਦ ਹੈ ਅਤੇ ਸਾਈਕਲ 'ਤੇ ਸਮਾਂ ਤਾਂ ਬਹੁਤ ਲੱਗਦਾ ਜੇ ਤੁਸੀਂ ਕਿਤੇ ਜਾਂਦੇ ਹੋ ਪਰ ਸਾਈਕਲ ਦਾ ਸਫਰ ਆ ਤੁਹਾਡਾ ਤੁਹਾਡੀ ਇੱਕ ਸਰੀਰਕ ਤੌਰ 'ਤੇ ਕਸਰਤ ਵੀ ਹੁੰਦੀ ਹੈ ਅਤੇ ਤੁਹਾਨੂੰ ਜਿਵੇਂ ਰਸਤੇ 'ਚ ਜਾ ਰਹੇ ਹੋ ਤੁਸੀਂ ਜਿੱਥੇ ਮਰਜ਼ੀ ਰੁਕ ਸਕਦੇ ਹੋ ਕੁਛ ਤੁਹਾਡਾ ਅਲੱਗ ਤੋਂ ਕੁਛ ਦੇਖਣ ਨੂੰ ਜੀ ਕਰ ਰਿਹਾ ਤੁਸੀਂ ਸਾਈਕਲ 'ਤੇ ਜਾ ਰਹੇ ਹੋ ਜੇ ਤੁਸੀਂ ਮੋ ਗੱਡੀ 'ਚ ਹੋਵੋਂ ਜਾਂ ਮ ਬੱਸ 'ਚ ਹੋਵੋਂ ਤੁਸੀਂ ਉਹ ਚੀਜ਼ਾਂ ਨੂੰ ਨਹੀਂ ਦੇਖ ਸਕਦੇ ਸਾਈਕਲ 'ਤੇ ਹੋਵੋਂਗੇ ਤਾਂ ਤੁਸੀਂ ਜਿੱਥੇ ਮਰਜ਼ੀ ਰੁਕ ਸਕਦੇ ਹੋ ਅਤੇ ਸਾਈਕਲ ਦਾ ਅਤੇ ਸਾਈਕਲ 'ਤੇ ਜਾਣ ਲਈ ਸਾਨੂੰ ਜਿਵੇਂ ਸਾਡੇ ਕੋਲ ਦੋ ਦਿਨ ਦੀ ਛੁੱਟੀ ਹੁੰਦੀ ਹੈ ਅਸੀਂ ਆਰਾਮ ਨਾਲ ਉਹ ਦੋ ਦਿਨ ਦੇ ਵਿੱਚ ਵਿੱਚ ਆਪਣਾ ਜਿ ਟੂਰ ਕਰ ਸਕਦੇ ਹਾਂ ਅਤੇ ਪਹਿਲਾਂ ਥੋੜ੍ਹਾ ਜਿਹਾ ਔਖਾ ਹੁੰਦਾ ਸੀਗਾ ਅਤੇ ਸਾਈਕਲ ਦੂਜੇ ਲੋਟ ਦੇ ਹੁੰਦੇ ਸੀ ਜਿਹੜੇ ਅ ਆਮ ਸਿੰਪਲ ਸਾਇਕਲ ਹੁੰਦੇ ਸੀਗੇ ਹੁਣ ਤਾਂ ਬਹੁਤ ਜ਼ਿਆਦਾ ਵਧੀਆ ਵਧੀਆ ਸਾਈਕਲ ਆਉਣ ਲੱਗ ਗਏ ਮਹਿੰਗੇ ਮਹਿੰਗੇ ਸਾਈਕਲ ਆਉਂਦੇ ਨੇ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਸਾਈਕਲਿੰਗ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ ਤੁਸੀਂ ਸਾਈਕਲ ਚਲਾਉ ਅਤੇ ਜਿਵੇਂ ਬਾਈਕ ਦੀ ਤਰ੍ਹਾਂ ਉੱਡਦੇ ਜਾਂਦੇ ਨੇ ਸਾਇਕਲ ਸਾਈਕਲ ਦੇ ਵਿੱਚ ਸਮਾਨ ਵੀ ਜ਼ਰੂਰਤ ਹੁੰਦਾ ਵੀ ਜਿਵੇਂ ਕਿ ਤੁਸੀਂ ਗੋਡਿਆਂ 'ਤੇ ਲਾਉਣ ਵਾਲੇ ਗਾਡ ਹੁੰਦੇ ਨੇ ਅਤੇ ਬਾਹਾਂ ਕੂਹਣੀ 'ਤੇ ਲਾਉਣ ਵਾਲੇ ਹੁੰਦੇ ਨੇ ਅਤੇ ਅ ਐਨਕਾਂ ਹੁੰਦੀਆਂ ਨੇ ਉੱਪਰ ਹੈਲਮਟ ਹੁੰਦਾ ਪਾਣੀ ਦੀ ਬੋਤਲ ਆ ਅੱਗੇ ਲਾਈਟ ਲੱਗੀ ਹੁੰਦੀ ਆ ਅਤੇ ਨਾਲ ਪੰਪ ਹੋਣਾ ਜ਼ਰੂਰੀ ਆ ਅਤੇ ਤੁਹਾਡੇ ਲਈ ਤੁਸੀਂ ਕੈਰੀ ਬੈਗ ਤੁਹਾਡਾ ਜ਼ਰੂਰੀ ਆ ਅਤੇ ਕੁਛ ਫੂਡ ਜ਼ਰੂਰੀ ਨੇ ਵੀ ਰਸਤੇ 'ਚ ਜੇ ਤੁਹਾਨੂੰ ਕੁਛ ਖਾਣਾ ਪੈ ਗਿਆ ਸਾਈਕਲਿੰਗ ਦਾ ਆਪਣਾ ਹੀ ਆਨੰਦ ਹੁੰਦਾ ਸਾਈਕਲਿੰਗ ਜ਼ਰੂਰੀ ਕਰਨੀ ਚਾਹੀਦੀ ਹੈ